ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕਿਆ ਹਾਲ ਚਾਲ ਹੈ ਹੋਰ ਸਭ ਵਧੀਆ ਜੀ ਤੁਸੀਂ ਭਾਅ ਜੀ ਉਥੇ ਸ਼ਗਨ ਰੈਸਟੋਰੈਂਟ ਤੋਂ ਬੋਲਦੇ ਹੈਗੇ ਆ ਮੈਂ ਭਾਅ ਜੀ ਤੁਹਾਡੇ ਨਾ ਉਹਤੇ ਮਤਲਬ ਰੈਸਟੋਰੈਂਟ ਤੋਂ ਸਮੋਸੇ ਟਿੱਕੀਆਂ ਭੱਲੇ ਬਰਗਰ ਵਗੈਰਾ ਹੀ ਸਭ ਔਡਰ ਕੀਤਾ ਸੀਗਾ ਤੁਹਾਡੀ ਭਾਅ ਜੀ ਚਟਣੀ ਬੜੀ ਸਵਾਦ ਹੁੰਦੀ ਹੈਗੀ ਆ ਭਾਅ ਜੀ ਉਹ ਥੋੜ੍ਹੀ ਜਿਹੀ ਹੋਰ ਐਡ ਕਰ ਦਿਓ ਮਤਲਬ ਜਿੰਨੀ ਪਾਈ ਹੈ ਉਹ ਤੋਂ ਥੋੜ੍ਹੀ ਜਿਹੀ ਇੱਕ ਦੋ ਪਾਊਚ ਹੋਰ ਜ਼ਿਆਦਾ ਪਾ ਦਿਓ ਇਹ ਤੋਂ ਇਲਾਵਾ ਭਾਅ ਜੀ ਮੈਂ ਤੁਹਾਡੇ ਤੋਂ ਉਹ ਪਤਾ ਕਰਨਾ ਸੀਗਾ ਬਈ ਬਈ ਜਿੱਦਾਂ ਉਹ ਹੁੰਦਾ ਹੈਗਾ ਏ ਇਹ ਇਹਦੇ ਤੋਂ ਇਲਾਵਾ ਤੁਸੀਂ ਹੋਰ ਮਤਲਬ ਕਿਹੜੀਆਂ ਕਿਹੜੀਆਂ ਚੀਜ਼ਾਂ ਰੱਖਦੇ ਹੈਗੇ ਆ ਜਿਦਾਂ ਹੁਣ ਮੰਨ ਲਓ ਪੀਜ਼ਾ ਹੋ ਗਿਆ ਖਾਣਾ ਵਗੈਰਾ ਤੂੰ ਵੀ ਰੱਖ ਤੁਸੀਂ ਰੱਖਦੇ ਹੈਗੇ ਆ ਭਾਅ ਜੀ ਜਿਦਾ ਖਾਣੇ ਜਿਹਦਾ ਪੀਜ਼ਾ ਦੇ ਹੋ ਗਏ ਇੱਕ ਵੈਜ ਹੋ ਗਿਆ ਨੋਨ ਵੈਜ ਹੋ ਗਿਆ ਇਹ ਤੋਂ ਇਲਾਵਾ ਭਾਅ ਜੀ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਰੱਖਦੇ ਹੈਗੇ ਆ ਠੀਕ ਆ ਭਾਅ ਜੀ ਠੀਕ ਆ ਜੀ ਧੰਨਵਾਦ ਭਾਅ ਜੀ ਦੱਸਣ ਵਾਸਤੇ ਠੀਕ ਆ ਭਾਅ ਜੀ ਮੈਨੂੰ ਉਹ ਭਾਅ ਜੀ ਦੱਸ ਦਿਓ ਵੀ ਡਿਸਕਾਊਂਟ 'ਤੇ ਹੁੰਦਾ ਨਾ ਡਿਸਕਾਊਂਟ 'ਤੇ ਦੱਸ ਦਿਓ ਭਾਅ ਜੀ ਵੀ ਕਿਹੜੇ ਕਿਹੜੇ ਦਿਨ ਤੁਹਾਡੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਡਿਸਕਾਊਂਟ 'ਤੇ ਚੱਲਦੀਆਂ ਹੁੰਦੀਆਂ ਹੈਗੀਆਂ ਏ ਉਹਦੇ ਹਿਸਾਬ ਨਾਲ ਅਸੀਂ ਕਰਲੂਂਗੇ ਭਾਅ ਜੀ ਔਡਰ ਫਿਰ ਤੁਹਾਨੂੰ ਵੀ ਭਾਅ ਜੀ ਥੋੜ੍ਹਾ ਬਹੁਤਾ ਬੈਨੀਫਿਟ ਹੋਜੂਗਾ ਫਿਰ ਠੀਕ ਆ ਭਾਅ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਜੀ